ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਜੀ ਆਪਣੇ ਇੱਥੇ ਜੀ ਤਾਜ਼ੀ ਸਬਜ਼ੀ ਤਾਂ ਨਾ ਜਿਹੜੀ ਸਬਜ਼ੀ ਮੰਡੀ ਲੱਗਦੀ ਹੈ ਬੱਸ ਸਟੈਂਡ ਪਤਾ ਤੁਹਾਨੂੰ ਨਵੇਂ ਸ਼ਹਿਰ ਦਾ ਬਾ ਬਸ ਸਟੈਂਡ ਤੋਂ ਨਾ ਥੋੜ੍ਹੀ ਜਿਹੀ ਪਹਿਲੇ ਹੀ ਸੱਜੇ ਹੱਥ ਬਸ ਸਟੈਂਡ ਵਾਲੇ ਪਾਸੇ ਹੀ ਸਬਜ਼ੀ ਮੰਡੀ ਲੱਗਦੀ ਆ ਉੱਥੋਂ ਤੁਹਾਨੂੰ ਵਧੀਆ ਤਾਜ਼ੀਆਂ ਸਬਜ਼ੀਆਂ ਮਿਲ ਜਾਂਦੀਆਂ ਅਤੇ ਥੋੜ੍ਹਾ ਬਹੁਤਾ ਦੂਰ ਪੈਂਦਾ ਪਰ ਉੱਥੇ ਸਬਜ਼ੀਆਂ ਤੁਹਾਨੂੰ ਵਧੀਆ ਤਾਜ਼ੀਆਂ ਵੀ ਮਿਲਦੀਆਂ ਅਤੇ ਰੇਟ ਵੀ ਸਹੀ ਲੱਗਦਾ ਅਤੇ ਬਹੁਤ ਹਾਂਜੀ

ਹਾਂਜੀ ਦੱਸੋ ਹਾਂਜੀ ਹਾਂਜੀ ਮਹਿੰਗੀ ਵੀ ਬਹੁਤ ਲਾਉਂਦੇ ਆ ਜੀ ਹਾਂਜੀ ਹਾਂਜੀ ਹਾਂਜੀ ਇਹ ਜਿਹੜੇ ਘਰਾਂ 'ਚ ਆਉਂਦੇ ਆ ਨਾ ਇਹ ਬਹੁਤ ਮਹਿੰਗੀ ਲਾਉਂਦੇ ਸਬਜ਼ੀ ਨਾਲੇ ਇਹਨਾਂ ਕੋਲ ਉਨੀ ਤਾਜ਼ੀ ਨਹੀਂ ਹੁੰਦੀ ਇਹ ਤਾਂ ਬਚਿਆ ਕੂਛਿਆ ਲੈ ਆਉਂਦੇ ਆ ਇਹ ਤਾਂ ਜੇ ਕਦੇ ਆਪਾਂ ਨਾ ਜਾ ਸਕੀਏ ਠੰਡ ਠੁੰਡ ਹੋਵੇ ਤਾਂ ਇਹਨਾਂ ਤੋਂ ਲੈ ਲਈ ਦੀ ਆ ਅੜਦੀ ਥੁੜਦੀ ਨੂੰ ਨਹੀਂ ਤੁਸੀਂ ਉੱਥੇ ਨਾ ਸਬਜ਼ੀ ਮੰਡੀ ਕੋਸ਼ਿਸ਼ ਕਰੋ ਕਿ ਉੱਥੋਂ ਜਾ ਕੇ ਲਿਆਇਆ ਕਰੋ ਜਾਂ ਫਿਰ ਇੱਥੋਂ ਨਾ ਆਪਣੇ ਡੀ ਸੀ ਦਫਤਰ ਹੈ ਜਿਹੜਾ ਉਹਦੇ ਅੱਗੇ ਵੀ ਨਾ ਰੇੜੀਆਂ ਲੱਗ ਜਾਂਦੀਆਂ ਦੁਪਹਿਰ ਵੇਲੇ ਵੀ ਹੁੰਦੇ ਹੈ ਫਿਰ ਸ਼ਾਮ ਵੇਲੇ ਵੀ ਉੱਥੇ ਜਿਹੜੀਆਂ ਰੇੜੀਆਂ ਉਹਨਾਂ ਕੋਲ ਫਿਰ ਵੀ ਚੰਗੀ ਹੁੰਦੀ ਹੈ ਸਬਜ਼ੀ ਉਹਨਾਂ ਦੀ ਰੇਟ ਵੀ ਇਹਨਾਂ ਨਾਲੋਂ ਚੰਗਾ ਇੱਥੇ ਵਾਲੇ ਤਾਂ ਬਹੁਤ ਲੁੱਟਦੇ ਹੈ ਹਾਂਜੀ ਆਪਾਂ ਚੱਲਾਂਗੇ ਤੁਸੀਂ ਦੱਸੋ ਕਦੋਂ ਜਾਣਾ ਜੀ ਠੀਕ ਹੈ ਕੋਈ ਨਾ ਆਪਾਂ ਚੱਲ ਪੈਨੇ ਆ ਸ਼ਾਮ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ